ਹੈਲੋ ਸਤਿ ਸ਼੍ਰੀ ਅਕਾਲ ਮੈਮ ਰੇਲਵੇ ਸਟੇਸ਼ਨ ਤੋਂ ਬੋਲ ਰਹੇ ਹੋ ਹਾਂਜੀ ਮੈਮ ਸਟੇਸ਼ਨ ਬਾਰੇ ਹੀ ਜਾਣਕਾਰੀ ਲੈਣੀ ਸੀ ਜਿਹੜਾ ਇਹ ਸਟੇਸ਼ਨ ਹੈ ਇਹ ਮਤਲਬ ਇਹਦੇ ਨਾਲ ਕਿਹੜੇ ਕਿਹੜੇ ਸ਼ਹਿਰ ਕਨੈਕਟਿਡ ਹੈ ਮਤਲਬ ਕਿੱਥੇ ਕਿੱਥੇ ਜਾਂਦੀ ਹੈ ਟ੍ਰੇਨ ਅੱਛਾ ਮੈਮ ਇੱਥੇ ਕੁਲੀ ਦੀ ਕੁਲੀ ਉਪਲੱਬਧ ਹੈ ਮਤਲਬ ਸਾਮਾਨ ਸਮੂਣ ਚੱਕਣ ਲਈ ਕੁਲੀ ਹੈ ਇੱਥੇ ਅੱਛਿਆ ਅਤੇ ਮੈਮ ਸਾਫ ਸਫ਼ਾਈ ਦਾ ਸਾਫ ਸਫ਼ਾਈ ਦਾ ਕੀ ਪ੍ਰਬੰਧ ਹੈ ਮੈਮ ਅੱਛਾ ਮੈਮ ਸਟੇਸ਼ਨ ਬਿਲਕੁਲ ਸਾਫ਼ ਸੁਥਰੇ ਅਤੇ ਟਰੇਨ ਵੀ ਸਾਫ਼ ਸੁਥਰੀ ਅਤੇ ਮੈਮ ਖਾਣ ਪੀਣ ਦਾ ਕੁੱਝ ਪ੍ਰਬੰਧ ਹੈ ਇੱਥੇ ਖਾਣ ਪੀਣ ਲਈ ਅਸੀਂ ਮੋਹਾਲੀ ਤੋਂ ਜਾਣਾ ਹੈ ਜੀ ਅਸੀਂ ਲੁਧਿਆਣੇ ਹਾਂਜੀ ਜੀ ਬਸ ਐਵੇਂ ਹੀ ਜਾਣਕਾਰੀ ਲੈਣੀ ਸੀ ਕਿ ਸਾਫ਼ ਸਫ਼ਾਈ ਦਾ ਕਿਵੇਂ ਪ੍ਰਬੰਧ ਹੈ ਰੇਲਗੱਡੀ 'ਚ ਅੱਛਾ ਮੈਮ ਟਰੇਨ ਲਈ ਅਲੱਗ ਰੱਖੇ ਹੋਏ ਹੈ ਅਤੇ ਉੱਥੇ ਸਟੇਸ਼ਨ ਲਈ ਅਲੱਗ ਰੱਖੇ ਹੋਏਂ ਅੱਛਾ ਮੈਮ ਹਾਂਜੀ ਠੀਕ ਹੈ ਮੈਮ ਠੀਕ ਹੈ ਜੀ ਥੈਂਕਯੂ